ਮੇਰੀ ਹਰ ਸਮੇਂ ਦੀ ਮਨਪਸੰਦ ਪਕਵਾਨ ਜੋ ਹੈ ਉਹ ਹੈ ਦਹੀਂ ਵਾਲੀ ਸ਼ਿਮਲਾ ਮਿਰਚ ਦੀ ਸਬਜ਼ੀ ਇਹ ਸਬਜ਼ੀ ਮੇਰੀ ਮਨਪਸੰਦ ਇਸ ਕਰਕੇ ਹੈ ਕਿਉਂਕਿ ਜਿਹੜਾ ਇਹਦਾ ਸਵਾਦ ਹੈ ਇਹ ਬਾਕੀਆਂ ਸਬਜ਼ੀਆਂ ਦਾਲਾਂ ਵਗੈਰਾ ਨਾਲੋਂ ਸਭ ਤੋਂ ਜ਼ਿਆਦਾ ਅਲੱਗ ਹੈ ਅਤੇ ਮੈਂ ਇਸਨੂੰ ਪਸੰਦ ਇਸ ਕਰਕੇ ਕਰਦੀ ਹਾਂ ਕਿਉਂਕਿ ਜਦੋਂ ਮੈਂ ਇਸਨੂੰ ਖਾਂਦੀ ਹਾਂ ਤਾਂ ਮੈਨੂੰ ਇੱਕ ਅਲੱਗ ਜਿਹਾ ਹੀ ਸਵਾਦ ਆਉਂਦਾ ਹੈ ਇਹਦੇ ਵਿੱਚ ਦਹੀਂ ਵੇਸਣ ਇਹ ਜਦੋਂ ਆਪਸ ਦੇ ਵਿੱਚ ਮਿਲਦੇ ਹਨ ਤਾਂ ਇਹ ਇੱਕ ਖੱਟਾ ਮਿੱਠਾ ਨਮਕ ਮਿਰਚ ਵਾਲਾ ਇੱਕ ਉਹ ਬਣਾਉਂਦੇ ਹਨ ਮਿਸਚਰ ਬਣਾਉਂਦੇ ਹਨ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਇਹ ਸਬਜ਼ੀ ਮੇਰੇ ਘਰਦਿਆਂ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਅਤੇ ਦੂਜੀ ਚੀਜ਼ ਇਹ ਹੈ ਕਿ ਜਿਹੜੀ ਸ਼ਿਮਲਾ ਮਿਰਚ ਹਰੀ ਸ਼ਿਮਲਾ ਮਿਰਚ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਨੂੰ ਇਹ ਇੰਨੀ ਪਸੰਦ ਹੈ ਕਿ ਜਦੋਂ ਮੇਰੇ ਮੰਮੀ ਇਹਨਾਂ ਨੂੰ ਕੱਟਦੀ ਹੁੰਦੀ ਹਨ ਕੱਚੀ ਨੂੰ ਤਾਂ ਮੈਂ ਕੱਚੀ ਨੂੰ ਚੱਕ ਕੇ ਸ਼ਿਮਲਾ ਮਿਰਚ ਨੂੰ ਖਾ ਲੈਂਦੀ ਹਾਂ ਕਿਉਂਕਿ ਜਦੋਂ ਅਸੀਂ ਸਬਜ਼ੀ ਨੂੰ ਖਾਂਦੇ ਹਾਂ ਤਾਂ ਅੰਦ ਮੂੰਹ ਦੇ ਵਿੱਚੋਂ ਵੀ ਉਹ ਸ਼ਿਮਲਾ ਮਿਰਚ ਦਾ ਟੇਸਟ ਕਾਫੀ ਦੇਰ ਤੱਕ ਨਹੀਂ ਜਾਂਦਾ ਅਤੇ ਜਦੋਂ ਸਬਜ਼ੀ ਮੈਂ ਇਹਨੂੰ ਖਾਂਦੀ ਹਾਂ ਤਾਂ ਮੈਂ ਉਸ ਸਬਜ਼ੀ ਦੇ ਨਾਲ ਘੱਟੋਂ ਘੱਟ ਛੇ ਸੱਤ ਰੋਟੀਆਂ ਖਾ ਜਾਂਦੀ ਹਾਂ ਕਿਉਂਕਿ ਮੈਨੂੰ ਇਹ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਇਹਦੇ ਵਿੱਚ ਜਿਹੜਾ ਨਮਕ ਮਿਰਚਾਂ ਆਦਿ ਆ ਆਦਿ ਦਾ ਅਸੀਂ ਇਸਤੇਮਾਲ ਕਰਦੇ ਹਾਂ ਉਹ ਵੀ ਬਿਲਕੁਲ ਸਹੀ ਤਰੀਕੇ ਨਾਲ ਬਿਲਕੁਲ ਸਹੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਅਤੇ ਇਹਦੇ 'ਚ ਕੱਚੇ ਪਿਆਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਖਾਣੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੇ ਹਨ ਅਤੇ ਜਿਹੜਾ ਇਹਦਾ ਦਾ ਸੁੱਕਾ ਮਸਾਲਾ ਹੁੰਦਾ ਦਹੀਂ ਅਤੇ ਵੇਸਣ ਵਾਲਾ ਉਹ ਤਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਂ ਇਹਨੂੰ ਬਹੁਤ ਖੁਸ਼ ਖੁਸ਼ ਹੋ ਕੇ ਖਾਂਦੀ ਹਾਂ